ਸੱਤ ਨਵੰਬਰ ਉੱਨੀ ਸੌ ਅਠਾਨਵੇਂ ਨੌ ਮਈ ਦੋ ਹਜ਼ਾਰ ਦਸ ਗਿਆਰ੍ਹਾਂ ਦਿਸੰਬਰ ਦੋ ਹਜ਼ਾਰ ਗਿਆਰ੍ਹਾਂ ਛੱਬੀ ਜਨਵਰੀ ਦੋ ਹਜ਼ਾਰ ਤੇਈ ਅਠਾਰ੍ਹਾਂ ਨਵੰਬਰ ਦੋ ਹਜ਼ਾਰ ਤੇਈ